ਹਾਂਜੀ ਮੇਰੇ ਇੱਕ ਵੱਡੀ ਭੈਣ ਹੈ ਅਤੇ ਇੱਕ ਛੋਟਾ ਭਰਾ ਹੈ ਭੈਣ ਮੇਰੇ ਤੋਂ ਡੇਢ ਸਾਲ ਵੱਡੀ ਹੈ ਅਤੇ ਭਰਾ ਮੇਰੇ ਤੋਂ ਗਿਆਰਾਂ ਸਾਲ ਛੋਟਾ ਹੈ ਅਸੀਂ ਸਾਡੇ ਅੰਦ ਸਾਡੇ ਤਿੰਨਾਂ ਦੇ ਵਿੱਚ ਕਾਫੀ ਚੀਜ਼ਾਂ ਸਮਾਨ ਵੀ ਹਨ ਜਿੱਦਾਂ ਕਿ ਅਸੀਂ ਇੱਕੋ ਘਰ 'ਚ ਜੰਮੇ ਪਲੇ ਹਾਂ ਅਤੇ ਸਾਨੂੰ ਇਕ ਦੁਜ ਇੱਕ ਦੂਜੇ ਦੀਆਂ ਸਾਰੀਆਂ ਕਮਜ਼ੋਰੀਆਂ ਅਤੇ ਤਾਕਤਾਂ ਪਤਾ ਹਨ ਅਤੇ ਮੇਰੀ ਵੱਡੀ ਭੈਣ ਮੇਰੇ ਤੋਂ ਕਾਫੀ ਜ਼ਿਆਦਾ ਹੁਸ਼ਿਆਰ ਸੀਗੀ ਅਤੇ ਛੋਟਾ ਭਰਾ ਵੀ ਮੇਰੇ ਤੋਂ ਹੁਸ਼ਿਆਰ ਸੀ ਪਰ ਅਸੀਂ ਪੜ੍ਹਾਈ ਦੇ ਵਿੱਚ ਜਦੋਂ ਪੜ੍ਹਦੇ ਸੀ ਇੱਕੋ ਸਮਾਨ ਨੰਬਰ ਲਈ ਦੇ ਸੀ ਪਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਫੀਲਡ ਕੰਮ ਕਰਨ ਦੇ ਜਿਹੜੇ ਤਰੀਕੇ ਬਦਲ ਗਏ ਹਨ ਜਿੱਦਾਂ ਕਿ ਉਹ ਬੈਂਕ 'ਚ ਲੱਗੀ ਹੈ ਮੈਂ ਫਾਰਮਾ ਲਾਈਨ ਦੇ ਵਿੱਚ ਹੈਗਾ ਵਾ ਦਵਾਈਆਂ ਦੀ ਕੰਪਨੀ 'ਚ ਲੱਗਾ ਹਾਂ ਅਤੇ ਛੋਟਾ ਭਰਾ ਮੇਰਾ ਅਕਾਊਂਟਿੰਗ ਦੇ ਕੰਮ ਦੇ ਵਿੱਚ ਹੈ ਇਸ ਤਰ੍ਹਾਂ ਅਸੀਂ ਭਿੰਨ ਭਿੰਨ ਰਸਤਿਆਂ 'ਤੇ ਚੱਲਦੇ ਪਏ ਹਾਂ ਅਤੇ ਪਰ ਸਾਡੀ ਜਿਹੜੀ ਰਹਿਣ ਸਹਿਣ ਘਰ ਬਾਰ ਸੇਮ ਹੀ ਹੈ ਇੱਕੋ ਜਿਹਾ ਹੈ ਆਉਣ ਵਾਲੇ ਟਾਈਮ 'ਚ ਅਸੀਂ ਥੋੜ੍ਹਾ ਬਹੁਤਾ ਅੱ ਅੱਗੇ ਪਿੱਛੇ ਹਾਂ ਥੈਂਕ ਯੂ ਜੀ